ਮੇਰੀ ਜ਼ਿੰਦਗੀ ਵਿੱਚ ਮੇਰੇ ਬਹੁਤ ਟੀਚੇ ਅਤੇ ਇੱਛਾਵਾਂ ਹਨ ਮੇਰੀ ਇੱਸਿਆ ਇਹ ਹੈ ਕਿ ਮੈਂ ਸਭ ਤੋਂ ਪਹਿਲਾਂ ਵੀ ਮੈਨੂੰ ਨੌਕਰੀ ਗੌਰਮਿੰਟ ਨੌਕਰੀ ਮਿਲ ਜਾਵੇ ਜਿਸ ਲਈ ਮੈਂ ਦਿਨ ਰਾਤ ਮਿਹਨਤ ਕਰਦਾ ਹਾਂ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਹੱਥ ਪੱਲੇ ਕੁਝ ਵੀ ਨਹੀਂ ਪੈਂਦਾ ਅਤੇ ਫਿਰ ਵੀ ਮੈਂ ਆਪਣੇ ਵੱਲੋਂ ਕੋਸ਼ਿਸ਼ ਨਹੀਂ ਛੱਡਦਾ ਦਿਨ ਰਾਤ ਮਿਹਨਤ ਕਰਦਾ ਹਾਂ ਅਤੇ ਹੁਣ ਵੀ ਮੇਰੀ ਇਹੀ ਇੱਛਾ ਹੈ ਕਿ ਮੈਂ ਸਰਕਾਰੀ ਨੌਕਰੀ ਲੱਗ ਜਾਵਾਂ ਜੇ ਮੈਂ ਸਰਕਾਰੀ ਨੌਕਰੀ ਲੱਗ ਗਿਆ ਜਿਸ ਨਾਲ ਮੇਰੀ ਚੰਗੀ ਸੈਲਰੀ ਹੋ ਜਾਵੇਗੀ ਅਤੇ ਇਹ ਮੇਰੀ ਜਿਹੜੀ ਘਰ ਦੀਆਂ ਜ਼ਰੂਰਤਾਂ ਹੈ ਉਹ ਪੂਰੀਆਂ ਹੋ ਜਾਵੇ ਅਤੇ ਮੇਰੇ ਮਾਂ ਬਾਪ ਅਤੇ ਮੇਰੇ ਵਾਈਫ ਅਤੇ ਬੱਚੇ ਦੀ ਜ਼ਿੰਦਗੀ ਹੈ ਬਹੁਤ ਵਧੀਆ ਹੋ ਜਾਵੇਗੀ ਅਤੇ ਮੈਂ ਆਪਣੇ ਜਿਹੜੇ ਬੱਚਿਆਂ ਦੀ ਜ਼ਿੰਦਗੀ ਆ ਉਹਨਾਂ ਦੀ ਲਾਈਫ ਸੈੱਟ ਕਰਨ ਵਿੱਚ ਕੋਈ ਕਮੀ ਪੇਸ਼ੀ ਨਾ ਛੱਡਾ ਇਹ ਮੇਰੇ ਇੱਛਾ ਹੈ ਅਤੇ ਮਾਂ ਬਾਪ ਦੀ ਹਰੇਕ ਇੱਛਾ ਪੂਰੀ ਕਰਾਂ ਉਹਨਾਂ ਨੂੰ ਜੋ ਵੀ ਉਹ ਕਹਿੰਦੇ ਆ ਉਹਨਾਂ ਦੀ ਇੱਛਿਆ ਪੂਰੀ ਕਰਾਂ